ਘਰ ਦੇ ਵਿੱਚ ਅਸੀਂ ਇੱਕ ਛੋਟੀ ਬਗੀਚੀ ਨੂੰ ਸ਼ੌਕ ਦੇ ਵਿੱਚ ਜਿਹੜਾ ਸ਼ੁਰੂ ਕੀਤਾ ਤਾਂ ਉਹਨੂੰ ਸ਼ੁਰੂ ਕਰਨ ਦੀ ਪ੍ਰੇਰਨਾ ਜਾਂ ਮਕਸਦ ਇਹ ਸੀ ਕਿ ਘਰ ਦੀਆਂ ਕੁਛ ਸਬਜ਼ੀਆਂ ਜਿਹੜੀਆਂ ਉਹ ਉਗਾਈਆਂ ਜਾਣ ਅਤੇ ਜਿਹੜੀਆਂ ਔਰਗੈਨਿਕ ਤਰੀਕੇ ਨਾਲ ਉਗਾਈਆਂ ਜਾਣ ਕਿ ਔਰਗੈਨਿਕ ਜਿਹੜੀਆਂ ਖਾਧੀਆਂ ਜਾਣ ਤਾਂ ਉਸ ਪ੍ਰੇਰਨਾ ਦੇ ਵਿੱਚੋਂ ਹੀ ਜਿਹੜੀ ਇੱਕ ਛੋਟੀ ਬਗੀਚੀ ਜਾਂ ਜਿਹੜੀ ਘਰ ਤਿਆਰ ਕੀਤੀ ਗਈ ਤਾਂ ਉਹ ਬਗੀਚੀ ਦੇ ਵਿੱਚ ਬਗੀਚੀ ਨੂੰ ਸ਼ੁਰੂ ਕਰਨ ਪਿੱਛੇ ਸ਼ੌਕ ਜਿਹੜਾ ਸੀਗਾ ਸ਼ੁਰੂ ਤੋਂ ਤਾਂ ਉਹ ਸ਼ੌ ਬਗੀਚੀ ਦੇ ਵਿੱਚ ਬੜੀਆਂ ਵੱਖ ਵੱਖ ਸੀਜ਼ਨ ਦੇ ਵਿੱਚ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਨੂੰ ਉਗਾਇਆ ਗਿਆ ਜਿਵੇਂ ਸਰਦੀ ਦੇ ਵਿੱਚ ਆਮ ਕਰਕੇ ਪਾਲਕ ਮੇਥੇ ਸਰ੍ਹੋਂ ਧਨੀਆ ਵਗੈਰਾ ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਬੀਜ ਲੈ ਕੇ ਉਹਨਾਂ ਨੂੰ ਬੀਜ ਕੇ ਤਾਂ ਉਹ ਜੇਕਰ ਉਹਨੂੰ ਚੰਗੀ ਖਾਦ ਔਰ ਪਾਣੀ ਜਿਹੜਾ ਸਮੇਂ 'ਤੇ ਦਿੱਤਾ ਜਾਂਦਾ ਇੱਕ ਤਾਂ ਘਰੇਲੂ ਬਗੀਚੀ ਨੂੰ ਤਾਂ ਉਹ ਇੱਕ ਬਹੁਤ ਵਧੀਆ ਰੂਪ ਦੇ ਵਿੱਚ ਜਿਹੜੀਆਂ ਇਹ ਸਬਜ਼ੀਆਂ ਨੇ ਉਹ ਉੱਗਦੀਆਂ ਨੇ ਅਤੇ ਦੂਜਾ ਇਹ ਕਿ ਇਹਨਾਂ ਦੇ ਵਿੱਚ ਜਿਹੜੀ ਜ਼ਿਆਦਾ ਦੇਸੀ ਰੇਹ ਉਹ ਵਰਤੀ ਜਾਂਦੀ ਆ ਸਪਰੇਹਾਂ ਤੋਂ ਜਾਂ ਜਿਹੜੀਆਂ ਹੋਰ ਪੈਸਟੀਸਾਈਜ਼ ਆ ਉਹਨਾਂ ਤੋਂ ਇਹਨਾਂ ਨੂੰ ਜਿਹੜਾ ਦੂਰ ਰੱਖਿਆ ਜਾਂਦਾ ਕਿਉਂਕਿ ਘਰ ਦਾ ਜਿਹੜਾ ਘਰ ਵਰਤਣ ਯੋਗ ਜਿਹੜੀਆਂ ਸਬਜ਼ੀਆਂ ਨੇ ਉਹ ਔਰਗੈਨਿਕ ਹੋਣ ਤਾਂ ਇਹ ਸਾਰਿਆਂ ਲਈ ਇੱਕ ਸੁਝਾਅ ਵੀ ਹੈ ਕਿ ਜੇਕਰ ਤੁਹਾਡੇ ਕੋਲ ਘਰ ਕੋਈ ਥੋੜ੍ਹੀ ਜਗ੍ਹਾ ਹੈ ਬਗੀਚੀ ਬਣਾਉਣ ਨੂੰ ਤਾਂ ਜ਼ਰੂਰ ਹਰ ਇੱਕ ਬੰਦਾ ਜਿਹੜੀ ਉਹ ਘਰ ਦੀ ਆਪਣੀ ਇੱਕ ਬਗੀਚੀ ਤਿਆਰ ਕਰੇ ਤਾਂ ਥੋੜ੍ਹੀ ਥੋੜ੍ਹੀਆਂ ਜਿਹੜੀਆਂ ਸਾਰੀਆਂ ਸੀਜਨਲ ਸਬਜ਼ੀਆਂ ਨੇ ਜਿਵੇਂ ਹੁਣ ਗਰਮੀ ਦੇ ਵਿੱਚ ਭਿੰਡੀਆਂ ਹੋ ਗਈਆਂ ਗੁਆਰਾ ਹੋ ਗਿਆ ਜਾਂ ਮਿਰਚਾਂ ਹੋ ਗਈਆਂ ਟਮਾਟਰਾਂ ਦੀ ਪਨੀਰੀ ਹੋ ਗਈ ਤਾਂ ਇਹ ਥੋੜ੍ਹੀ ਥੋੜ੍ਹੀ ਜਗ੍ਹਾ ਦੇ ਵਿੱਚ ਜਿਹੜੀਆਂ ਸਾਰੀਆਂ ਲਾਈਆਂ ਜਾਣ ਤਾਂ ਹਰ ਇੱਕ ਬੰਦੇ ਲਈ ਇਹ ਜ਼ਰੂਰੀ ਹੈ ਕਿਹੜੀਆਂ ਰੋਜ਼ ਵਰਤੋਂ ਦੀਆਂ ਚੀਜ਼ਾਂ ਨੇ ਜਾਂ ਉਹਨਾਂ ਨੂੰ ਜਿਹੜਾ ਬੰਦਾ ਹਰੇਕ ਜਿਹੜਾ ਵਿਅਕਤੀ ਉਹ ਘਰ ਆਪਣੇ ਬਣਾ ਕੇ ਉਹਨਾਂ ਨੂੰ ਪੈਦਾ ਕਰ ਸਕਦਾ ਔਰ ਔਰਗੈਨਿਕ ਤਰੀਕੇ ਨਾਲ ਉਗਾ ਕੇ ਉਹਨਾਂ ਨੂੰ ਆਪਣੀ ਸਿਹਤ ਦੇ ਲਈ ਚੰਗੀ ਸਿਹਤ ਦੇ ਲਈ ਉਹਨਾਂ ਨੂੰ ਖਾ ਸਕਦਾ